ਸਤਿ ਸ਼੍ਰੀ ਅਕਾਲ ਸ਼੍ਰੀ ਮਾਨ ਜੀ ਮੈਂ ਪਿਛਲੇ ਕਾਫੀ ਸਮੇਂ ਤੋਂ ਤੁਹਾਡੇ ਰੈਸਟੋਰੈਂਟ ਤੋਂ ਭੋਜਨ ਆਡਰ ਕਰਦੀ ਆ ਰਹੀ ਹਾਂ ਅਤੇ ਇਸ ਭੋਜਨ ਦਾ ਭੁਗਤਾਨ ਆਨਲਾਈਨ ਮਾਧਿਅਮ ਰਾਹੀਂ ਕਰਦੀ ਆ ਰਹੀ ਹਾਂ ਪਰ ਹੁਣ ਤੁਹਾਡੇ ਰੈਸਟੋਰੈਂਟ ਨੇ ਭੁਗਤਾਨ ਸੀ ਓ ਡੀ ਰਾਹੀਂ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਮੈਨੂੰ ਠੀਕ ਨਹੀਂ ਲੱਗਦਾ ਇਸ ਕਰਕੇ ਮੈਂ ਮੇਰੇ ਦੁਆਰਾ ਕੀਤੇ ਗਏ ਸਾਰੇ ਆਰਡਰ ਰੱਦ ਕਰ ਰਹੀ ਹਾਂ ਅਤੇ ਭੋਜਨ ਮੰਗਵਾਉਣ ਲਈ ਕਿਸੇ ਹੋਰ ਰੈਸਟੋਰੈਂਟ ਨਾਲ ਸੰਪਰਕ ਕਰ ਰਹੀ ਹਾਂ ਤੁਹਾਡੇ ਰੈਸਟੋਰੈਂਟ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਭੋਜਨ ਬਹੁਤ ਚੰਗੀ ਕੁਆਲਿਟੀ ਦਾ ਹੈ ਜਿਸ ਦੀ ਮੈਂ ਤੁਹਾਡੇ ਪ੍ਰਤੀ ਹਮੇਸ਼ਾਂ ਸ਼ੁਕਰ ਗੁਜ਼ਾਰ ਰਹਾਂਗੀ ਪਰ ਮੈਨੂੰ ਹਮੇਸ਼ਾਂ ਅਫਸੋਸ ਰਹੇਗਾ ਕਿ ਕੇਵਲ ਭੁਗਤਾਨ ਕਰਨ ਦੇ ਇਸ ਵਿਕਲਪ ਕਰਕੇ ਮੈਨੂੰ ਕਿਸੇ ਹੋਰ ਰੈਸਟੋਰੈਂਟ ਨੂੰ ਚੁਣਨਾ ਪਵੇਗਾ ਪਰ ਨਾਲ ਹੀ ਇਹ ਆਸ ਵੀ ਹੈ ਕਿ ਤੁਸੀਂ ਇਸ ਛੋਟੇ ਜਿਹੇ ਮਸਲੇ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰੋਗੇ ਜਿਸ ਨਾਲ ਮੇਰਾ ਅਤੇ ਤੁਹਾਡੇ ਰੈਸਟੋਰੈਂਟ ਦਾ ਸੰਬੰਧ ਹਮੇਸ਼ਾਂ ਇਸੇ ਤਰ੍ਹਾਂ ਬਣਿਆ ਰਹੇ